ਹੈਲੋ ਹੈਲੋ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਹਾਂ ਹੋਰ ਕੀ ਹਾਲ ਹੈ ਹਾਂ ਵਧੀਆ ਠੀਕ ਠਾਕ ਹੋਰ ਸੁਣਾਓ ਬੱਚੇ ਤਾਂ ਵਧੀਆ ਪਰ ਆਪਣੀ ਗਲੀ ਦਾ ਕੋਈ ਹਾਲ ਨਹੀਂ ਗਾ ਐਡੇ ਐਡੇ ਟੋਏ ਹੋਏ ਪਏ ਆ ਹੋਰ ਤੇ ਹੁਣ ਬੰਦਿਆਂ ਨੇ ਵੀ ਲੰਘਣਾ ਉਥੋਂ ਮੋਟਰਸਾਈਕਲ ਲੈ ਕੇ ਤੇ ਬੱਚਿਆਂ ਨੇ ਵੀ ਖੇਡਣਾ ਤੇ ਹੁਣ ਬਜ਼ੁਰਗਾਂ ਨੇ ਵੀ ਲੰਘਣਾ ਤੇ ਆਪਾਂ ਵੀ ਰਲ ਕੇ ਗਲੀ ਆਨ ਨਾ ਕਰ ਲਈਏ ਪੈਸੇ ਇਕੱਠੇ ਤੇ ਵੀ

ਹਾਂ ਨਹੀਂ ਫਿਰ ਮੈਂ ਕਿਹਾ ਆਪਾਂ ਗੱਲ ਕਰੀਏ ਗਲੀ ਚ ਬਈ ਸਾਰੇ ਭਾਈ ਪੈਸੇ ਇਕੱਠੇ ਕਰੋ ਤੇ ਵੀ ਆਪਾਂ ਗਲੀ ਬਣਾਈਏ ਚਲੋ ਠੀਕ ਹ ਫਿਰ ਆਪਾਂ ਕਰਦੇ ਆ ਗੱਲ

ਹਾਂ ਹਾਂ ਹਾਂ ਠੀਕ ਹੈ ਆਹੋ ਵੀ ਮਿਸਤਰੀ ਨੂੰ ਬੁਲਾ ਕੇ ਵੀ ਕਹਿ ਦਿੰਦੇ ਕੋਈ ਚੰਗਾ ਵੀ ਹਨਾ ਤੇ ਵੀ

ਹਾਂ ਹਾਂ ਤੇ ਹਾਂ ਚਲੋ ਠੀਕ ਹੈ ਫਿਰ ਹਾਂ ਹਾਂ ਇਹ ਤਾਂ ਹੈ ਫਿਰ ਹੁਣ ਕਰਨਾ ਤਾਂ ਪਊਗਾ ਹੀ ਫਿਰ ਜਵਾਕਾਂ ਦੀਆਂ ਉਹ ਵਿਚਾਰੇ ਜਵਾਕ ਖੇਡਣ ਵੱਲੋਂ ਬੈਠੇ ਘਰੇ ਤੇ ਹੋਰ ਇੱਕ ਮੀਂਹ ਆ ਜਾਂਦਾ ਤੇ ਚਿੱਕੜ ਕਿੰਨਾ ਹੋ ਜਾਂਦਾ ਹਾਂ ਹਾਂ ਹਾਂ ਤੇ ਕਰਮ ਹਾਂ ਫਿਰ ਆਪਾਂ ਪੁੱਛ ਲੈਨੇ ਆ ਗਲੀ 'ਚ ਤੇ ਵੀ ਸਾਰੇ ਰਲ ਕੇ ਕਰਾ ਲੈਨੇ ਆ

ਹਾਂ ਫਿਰ ਹੁਣ ਸਵੇਰ ਤੋਂ ਪੁੱਛੀਏ ਹਾਂ ਠੀਕ ਹੈ ਚੰਗਾ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਹੈ ਠੀਕ ਹ ਸਤਿ ਸ੍ਰੀ ਅਕਾਲ